ਮੈਂ ਹੋਸਟਲ ਮੈਂ ਯੂਨੀਵਰਸਿਟੀ ਵਿੱਚ ਭੰਗੜੇ ਦਾ ਕੋਚ ਹਾਂ ਅਸੀਂ ਅ ਅਲੱਗ ਅਲੱਗ ਲਗ ਮੁਕਾਬਲਿਆਂ 'ਚ ਭੰਗੜੇ ਦੀਏ ਕਾਫ਼ੀ ਟ੍ਰੋਫੀਆਂ ਜਿੱਤੀਆਂ ਹੈ ਅਸੀਂ ਯੂਥ ਫੈਸਟੀਵਲ ਦੇ ਵਿੱਚ ਬੱਚਿਆਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਭੰਗੜੇ ਸਿਖਾਉਂਦੇ ਹਨ ਅਤੇ ਹੋਸਟਲ ਵੀ ਪ੍ਰਵਾਈਡ ਕਰਵਾਉਂਦੇ ਹਨ ਅਤੇ ਉਹ ਸਵੇਰੇ ਤੜਕੇ ਉੱਠ ਕੇ ਚਾਰ ਵਜੇ ਭੰਗੜੇ ਦੀ ਰਹਿਸਲ ਸ਼ੁਰੂ ਹੋ ਜਾਂਦੀ ਹੈ ਔਰ ਕਰਵਾਉਂਦੇ ਸਮੇਂ ਸਾਨੂੰ ਇੰਨਾ ਆਨੰਦ ਆਉਂਦਾ ਔਰ ਬੱਚੇ ਬਹੁਤ ਜ਼ਿਆਦਾ ਸ਼ੌ ਸ਼ੌਂਕ ਨਾਲ ਇਹ ਭੰਗੜੇ ਦੀ ਪ੍ਰੈਕਟਿਸ ਕਰਦੇ ਹਨ ਔਰ ਅਸੀਂ ਇੰਨੀਆਂ ਟ੍ਰੋਫੀਆਂ ਜਿੱਤੀਆਂ ਔਰ ਆਈ ਜੋਨ ਕਾਫ਼ੀ ਮਤਲਬ ਕਿ ਪਾਰਟੀਸਪੇਟ ਕੀਤੇ ਹਨ ਔਰ ਯੂਨੀਵਰਸਿਟੀ ਵਿੱਚ ਭੰਗੜੇ ਨੂੰ ਜ਼ਿਆਦਾ ਅਹਿਮੀਅਤ ਕੀਤੀ ਜਾਂਦੀ ਹੈ ਔਰ ਬੱਚੇ ਇਸ ਭੰਗੜੇ ਨੂੰ ਵੱਧ ਤੋਂ ਵੱਧ ਭਾਗ ਲੈਣ ਲਈ ਉਸ ਦਾ ਭਾਗ ਲੈਣ ਲਈ ਉਸਤਾਦ ਵੀ ਹੁੰਦੇ ਹਨ ਇਸ ਕਰਕੇ ਭੰਗੜੇ ਦੀ ਅਹਿਮੀਅਤ ਬਹੁਤ ਹੈ